ਹੈਲੋ ਹਾਂਜੀ ਹਾਂਜੀ ਟੂਰਿਸਟ ਗੈਂਨਡੈਂਸ ਮਿਸਟਰ ਰਾਜ ਗੱਲ ਕਰ ਰਿਹਾ ਜੀ ਹਾਂਜੀ ਹਾਂਜੀ ਅੱਛਾ ਅੱਛਾ ਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਵੀਰ ਜੀ ਅਸੀਂ ਤੁਹਾਨੂੰ ਚੰਗੀ ਤਰ੍ਹਾਂ ਗਾਈਡ ਕਰਾਂਗੇ ਚੰਗੀ ਤਰ੍ਹਾਂ ਜਿਹੜੀਆਂ ਬਠਿੰਡਾ ਮੇਨ ਪਲੇਸਸ ਆ ਵਧੀਆ ਦੇਖਣਯੋਗ ਉਹ ਤੁਹਾਨੂੰ ਅਸੀਂ ਦਿਖਾਵਾਂਗੇ ਚੰਗੀ ਤਰ੍ਹਾਂ ਗਾਈਡ ਕਰਾਂਗੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਵੇਗੀ ਜੀ ਤੁਸੀਂ ਕਿੰਨੀ ਡੇਟ ਨੂੰ ਪੁਹੰਚ ਜਾਓਗੇ ਜੀ ਬਠਿੰਡਾ ਉੱਨੀ ਜੂਨ ਨੂੰ ਠੀਕ ਆ ਜੀ ਤੇ ਤੁਸੀਂ ਮੋਰਨਿੰਗ ਪਹੁੰਚੋਗੇ ਜਾਂ ਈਵਨਿੰਗ ਦੇ ਵਿੱਚ ਪਹੁੰਚਣਾ ਜੀ ਮਾਰਨਿੰਗ ਤੁਸੀਂ ਕਿੰਨੇ ਵਜੇ ਸੱਤ ਵਜੇ ਆ ਜਾਓਗੇ ਜੀ ਮੈਂ ਸੱਤ ਵਜੇ ਤੁਹਾਨੂੰ ਆਪਣੀ ਕੈਬ ਲੈ ਆਵਾਂਗਾ ਜੀ ਅਤੇ ਤੁਹਾਨੂੰ ਸਟੇਸ਼ਨ ਤੋਂ ਡਰੋਪ ਕਰ ਲਵਾਂਗਾ ਜੀ ਠੀਕ ਆ ਜੀ ਤੁਹਾਨੂੰ ਪਿਕਅਪ ਕਰਕੇ ਸਟੇਸ਼ਨ ਤੋਂ ਅਤੇ ਤੁਹਾਨੂੰ ਇੱਕ ਵਾਰੀ ਹੋਟਲ ਦੇ ਵਿੱਚ ਲੈ ਜਾਵਾਂਗਾ ਤੁਸੀਂ ਉੱਥੋਂ ਫਰੈੱਸ਼ ਵਗੈਰਾ ਹੋ ਕੇ ਚੰਗੀ ਤਰ੍ਹਾਂ ਠੀਕ ਆ ਉਸ ਤੋਂ ਬਾਅਦ ਆਪਣਾ ਟੂਰ ਰਹੂਗਾ ਪਹਿਲਾਂ ਜੀ ਆਪਾਂ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਮੱਥਾ ਟੇਕਣ ਲਈ ਜਾਵਾਂਗੇ ਇਤਿਹਾਸਿਕ ਸਥਾਨ ਆ ਜੀ ਬਹੁਤ ਵਧੀਆ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਧਰਤੀ ਹੈਗੀ ਉਸ ਤੋਂ ਬਾਅਦ ਤੁਹਾਨੂੰ ਬਠਿੰਡਾ ਦੇ ਕਿਲ੍ਹਾ ਮੁਬਾਰਕ ਗੁਰਦੁਆਰਾ ਸਾਹਿਬ ਮੱਥਾ ਟਿਕਾਵਾਂਗੇ ਜੀ ਉਸ ਤੋਂ ਬਾਅਦ ਬਠਿੰਡਾ ਦੇ ਵਿੱਚ ਇੱਕ ਮਿੱਤਲ ਮੌਲ ਬਣਿਆ ਹੋਇਆ ਜੀ ਇੱਕ ਸਿਟੀ ਸਿਨੇਮਾ ਵਗੈਰਾ ਜੀ ਚੇਤਕ ਪਾਰਕ ਹੈਗਾ ਜੀ ਅਤੇ ਇੱਕ ਵੀ ਹੈਗੀ ਆ ਇਹ ਤੋਂ ਇਲਾਵਾ ਪਿੰਡਾਂ ਦੇ ਵਿੱਚ ਹੋਰ ਕਾਫੀ ਵਧੀਆ ਦੇਖਣਯੋਗ ਸਥਾਨ ਨੇ ਤੁਹਾਨੂੰ ਉੱਥੇ ਵੀ ਚੰਗੀ ਤਰ੍ਹਾਂ ਘੁਮਾ ਕੇ ਲੈ ਕੇ ਆਵਾਂਗੇ ਬਾਕੀ ਬਠਿੰਡਾ ਤੋਂ ਬਾਅਦ ਤੁਹਾਨੂੰ ਜੇ ਕਿਤੇ ਤੁਹਾਡੇ ਕੋਲ ਤਿੰਨ ਦਿਨ ਦੇ ਵਿੱਚ ਟਾਈਮ ਦੀ ਬੱਚਤ ਹੋਊਗੀ ਤਾਂ ਆਪਾਂ ਤੁਹਾਨੂੰ ਇੱਕ ਫਿਰੋਜ਼ਪੁਰ ਦੇ ਲਾਗੇ ਵਾਲਾ ਬਾਰਡਰ ਆ ਪਾਕਿਸਤਾਨ ਅਤੇ ਇੰਡੀਆ ਦਾ ਸਰਹੱਦੀ ਪਰੇਡ ਹੁੰਦੀ ਉੱਥੇ ਆਰਮੀ ਦੇ ਜਵਾਨ ਚੰਗੀ ਤਰ੍ਹਾਂ ਪਰੇਡ ਕਰਦੇ ਆ ਅਤੇ ਦਰਸ਼ਕਾਂ ਨੂੰ ਵਧੀਆ ਦੇਖਣਯੋਗ ਜਗ੍ਹਾ ਜੀ ਹਾਂਜੀ ਬਾਕੀ ਕੋਈ ਗੱਲ ਨਹੀਂ ਤੁਸੀਂ ਜਿਹੜੇ ਹਿਸਾਬ ਨਾਲ ਕਹੋਗੇ ਤੁਹਾਨੂੰ ਚੰਗੀ ਤਰ੍ਹਾਂ ਗਾਈਡ ਕਰਾਂਗੇ ਜੀ ਪਰੇਸ਼ਾਨੀ ਨਹੀਂ ਆਊਗੀ ਹੋਰ ਦੱਸੋ ਜੀ ਇਸ ਤੋਂ ਇਲਾਵਾ ਹੋਰ ਕੀ ਸੇਵਾ ਕਰ ਸਕਦੇ ਹਾਂ ਅਸੀਂ ਤੁਹਾਡੀ ਹਾਂਜੀ ਹਾਂਜੀ ਹਾਂਜੀ ਸਪੋਰਟਸ ਵਗੈਰਾ ਬਹੁਤ ਕੁਛ ਦੇਖਣ ਲਈ ਹੈ ਬਠਿੰਡਾ ਦਾ ਸਟੇਡੀਅਮ ਬਣਿਆ ਹੋਇਆ ਜੀ ਇੱਕ ਬਠਿੰਡਾ ਦੇ ਰਜਿੰਦਰਾ ਕੋਲਜ ਦੇ ਵਿੱਚ ਬਹੁਤ ਵਧੀਆ ਕ੍ਰਿਕਟ ਦਾ ਸਟੇਡੀਅਮ ਆ ਸ਼ਾਮ ਦੇ ਟਾਈਮ ਵੈਸੇ ਸਿਟੀਜ ਅ ਟੀਮਾਂ ਦੇ ਕ੍ਰਿਕੇਟ ਟੂਰਨਾਮੈਂਟ ਹੁੰਦੇ ਰਹਿੰਦੇ ਆ ਅਤੇ ਹਰ ਇੱਕ ਸੰਡੇ ਨੂੰ ਇੱਕ ਮੈਚ ਕਰਵਾਏ ਜਾਂਦੇ ਆ ਜੀ ਅਲੱਗ ਅਲੱਗ ਟੀਮਾਂ ਭਾਗ ਲੈਦੀਆਂ ਫਸਟ ਟੀਮ ਆਉਣ ਵਾਲੀ ਟੀਮ ਨੂੰ ਵਧੀਆ ਪ੍ਰਾਈਜ਼ ਦਿੱਤੇ ਜਾਂਦੇ ਆ ਬਾਕੀ ਕੋਈ ਗੱਲ ਨਹੀਂ ਇਹਨਾਂ ਤੋਂ ਇਲਾਵਾ ਹੋਰ ਵੀ ਗਰਾਊਂਡ ਵਗੈਰਾ ਤੁਹਾਨੂੰ ਦਿਖਾਵਾਂਗੇ ਠੀਕ ਆ ਵੀਰ ਜੀ ਪੈਸਿਆਂ ਦਾ ਵੀਰ ਜੀ ਇੱਦਾਂ ਦਾ ਇੱਕ ਦਿਨ ਦਾ ਸਾਡਾ ਚਾਰ ਹਜ਼ਾਰ ਰੁਪਇਆ ਚਲਦਾ ਗਾ ਅਸੀਂ ਤੁਹਾਡੇ ਤੋਂ ਕੋਈ ਨਹੀਂ ਪੈਂਤੀ ਸੌ ਰੁਪਏ ਲਵਾਂਗੇ ਹਾਂਜੀ ਹਾਂਜੀ ਬਾਕੀ ਕੋਈ ਗੱਲ ਨਹੀਂ ਤੁਹਾਨੂੰ ਕਿਸੇ ਗੱਲ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਵੇਗੀ ਓਕੇ ਵੀਰ ਜੀ